ਸਭ ਤੋਂ ਪਹਿਲਾਂ ਜੀ ਚਿੱਤਰਕਾਰੀ ਬਹੁਤ ਬਹੁਤ ਜ਼ਰੂਰੀ ਹੈ ਸ਼ ਬੱਚਿਆਂ ਲਈ ਸਟਾਰਟਿੰਗ ਬੱਚਿਆਂ ਨੂੰ ਅਸੀਂ ਗਾਈਡ ਕਰਦੇ ਹਾਂ ਅਤੇ ਉਹ ਇੱਕ ਵਧੀਆ ਇੱਕ ਚਿੱਤਰਕਾਰ ਬਣ ਸਕਦੇ ਨੇ ਅਗਰ ਸਟਾਰਟਿੰਗ ਤੋਂ ਹੀ ਅਸੀਂ ਉਸ ਬੱਚਿਆਂ ਨੂੰ ਗਾਈਡ ਕਰੀਏ ਕੀਤਾ ਜਾਵੇ ਅਤੇ ਚਿੱਤਰਕਾਰੀ ਜਿਹੜੀ ਗੱਲ ਕਰੀਏ ਤਾਂ ਅਭਿਆਸ ਬਹੁਤ ਜ਼ਰੂਰੀ ਹੈ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜਦੋਂ ਚਿੱਤਰਕਾਰੀ ਕਰਦੇ ਹਾਂ ਤਾਂ ਸਾਡੀ ਗਲਤੀਆਂ ਹੁੰਦੀਆਂ ਉਹਨਾਂ ਨੂੰ ਸਹੀ ਕਰਨ ਲਈ ਪਹਿਲੇ ਕੁਛ ਡੋਟ ਕੁਛ ਬਿੰਦੂ ਦੇ ਨਾਲ ਅਸੀਂ ਬੱਚਿਆਂ ਨੂੰ ਦਿੱਤਾ ਜਾਵੇ ਕਿ ਇਹਨੂੰ ਮਿਲਾਓ ਜਿਹਨੂੰ ਅਸੀਂ ਮਿਲਾ ਮਿਲਾ ਕੇ ਕੁਛ ਵਧੀਆ ਤਰੀਕੇ ਨਾਲ ਬੱਚਾ ਆਪਣਾ ਇਸ ਚੀਜ਼ ਨੂੰ ਇੰਪਲੀਮੈਂਟ ਕਰਦਾ ਉਹਨੂੰ ਪ੍ਰਯੋਗ ਕਰ ਸਕਦਾ ਹੈ ਅਤੇ ਮੈਂ ਕਹਿੰਦਾ ਪਰਿਆ ਮੇਰੇ ਖਿਆਲ ਨੂੰ ਚਾਲ੍ਹੀ ਪੰਜਾਹ ਵਾਰ ਅਸੀਂ ਇਸ ਚੀਜ਼ ਨੂੰ ਕਰੀਏ ਪ੍ਰੈਕਟਿਸ ਕਰੀਏ ਤਾਂ ਦਿੱਕਤ ਨਹੀਂ ਆਵੇਗੀ ਅਤੇ ਮੈਂ ਚਾਹੁੰਦੇ ਹਾਂ ਕਿ ਬੱਚਾ ਇੱਕ ਚੀਜ਼ ਨੂੰ ਘੱਟ ਤੋਂ ਘੱਟ ਤੀਹ ਚਾਲ੍ਹੀ ਪੰਜਾਹ ਵਾਰ ਕਰੇਗਾ ਤਾਂ ਅੱਗੇ ਆਉਣ ਵਾਲੇ ਤਾਂ ਵਧੀਆ ਚਿੱਤਰਕਾਰ ਬਣ ਸਕਦਾ ਆ ਕੋਈ ਵੀ ਵੱਡਾ ਵੀ ਅਗਰ ਪ੍ਰੈਕਟਿਸ ਕਰਦਾ ਉਹ ਵੀ ਵਧੀਆ ਬਣ ਸਕਦਾ